ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਕਿ ਸਮਾਰਟਫੋਨ ਨੇ ਕਿਵੇਂ ਸਾਡੀ ਜ਼ਿੰਦਗੀ ਨੂੰ ਆਸਾਨ ਕਰ ਦਿੱਤਾ ਹੈ ਸਮਾਰਟਫੋਨ ਅੱਜ ਕੱਲ੍ਹ ਹਰ ਕੋਈ ਇਸਤੇਮਾਲ ਕਰਦਾ ਹੈ ਕੋਈ ਵੱਖ ਹੀ ਹੋਵੇਗਾ ਜਿਹੜਾ ਸਮਾਰਟਫੋਨ ਦੀ ਵਰਤੋਂ ਨਾ ਕਰਦਾ ਹੋਏ ਅੱਜ ਕੱਲ੍ਹ ਸਮਾਰਟਫੋਨ ਨੇ ਦੇ ਨਾਲ ਛੋਟੇ ਤੋਂ ਛੋਟਾ ਕੰਮ ਵੀ ਆਸਾਨ ਹੋ ਗਿਆ ਹੈ ਸਮਾਰਟਫੋਨ ਦੇ ਨਾਲ ਅਸੀਂ ਘਰ ਬੈਠੇ ਹੀ ਮੂਵੀ ਦੇਖ ਸਕਦੇ ਹਾਂ ਸਾਨੂੰ ਥੇਟਰ ਵਿੱਚ ਵਗੈਰਾ ਵਿੱਚ ਜਾਣ ਦੀ ਕੋਈ ਲੋੜ ਨਹੀਂ ਹੈ ਅਸੀਂ ਜੇ ਸਾਨੂੰ ਕਿਤੇ ਕਿਸੇ ਨਾਲ ਗੱਲ ਕਰਨੀ ਹੋਵੇ ਅਤੇ ਅਸੀਂ ਘਰ ਬੈਠੇ ਹੀ ਉਹਨੂੰ ਫੋਨ ਲਾ ਸਕਦੇ ਹਾਂ ਦੂਰ ਤੋਂ ਦੂਰ ਫੋਨ ਲੱਗਾ ਸਕਦੇ ਹਾਂ ਸਮਾਰਤਫੋਨ ਦੇ ਕਾਰਨ ਸਮਾਰਟਸਫੋਨ ਦੇ ਕਾਰਨ ਅਸੀਂ ਇੱਕ ਦੂਜੇ ਨੂੰ ਮੈਸਿਜ ਵਗੈਰਾ ਕਰ ਕੇ ਇਨਫੋਮੇਸ਼ਨ ਦੇ ਸਕਦੇ ਹਾਂ ਅੱਜ ਕੱਲ੍ਹ ਸਮਾਰਟਫੋਨ ਡੋ ਡੋਕਿਉਮੈਂਟਸ ਸਟੋਰ ਕਰਨ ਦੇ ਵੀ ਬਹੁਤ ਕੰਮ ਆਉਂਦਾ ਹੈ ਜਿਹਦੇ ਵਿੱਚ ਅਸੀਂ ਆਪਣੇ ਜ਼ਰੂਰੀ ਤੋਂ ਜ਼ਰੂਰੀ ਕਾਗਜ਼ਾਤ ਸੰਭਾਲ ਕੇ ਰੱਖ ਸਕਦੇ ਹਾਂ ਬਿਨਾਂ ਕਿਸੇ ਟੈਂਸ਼ਨ ਤੋਂ ਅਤੇ ਸਮਾਰਟਫੋਨ ਦੀ ਵਰਤੋਂ ਅੱਜ ਕੱਲ੍ਹ ਆਮ ਵੀ ਹੁੰਦੀ ਹੈ ਐਨਟਰਟੇਨਮੈਂਟ ਵਗੈਰਾ ਵਾਸਤੇ ਜਿਵੇਂ ਅੱਜ ਕੱਲ੍ਹ ਲੋਕ ਸੀਡੀ ਪਲੇਅਰ ਵਗੈਰਾ ਦੀ ਜਗ੍ਹਾ ਫੋਨ 'ਤੇ ਹੀ ਗਾਣੇ ਸੁਣ ਲੈਂਦੇ ਹੈ ਅਤੇ ਆ ਮੂਵੀਜ਼ ਵਗੈਰਾ ਸੋਸ਼ਲ ਮੀਡੀਆ ਚਲਾ ਕੇ ਆਪਣਾ ਐਟਰਟੇਨਮੈਂਟ ਕਰ ਲੈਂਦੇ ਹਾਂ ਪਰ ਪੁਰਾਣੇ ਟਾਈਮ 'ਚ ਇਵੇਂ ਨਹੀਂ ਹੁੰਦਾ ਸੀ ਸਮਾਟਫੋਨ ਦੇ ਕਾਰਨ ਜੇ ਜਿਹੜੇ ਬੱਚੇ ਵਗੈਰਾ ਹੈ ਉਹ ਬਾਹਰ ਖੇਡਣ ਦੇ ਬਜਾਏ ਘਰ ਘਰ ਬੈਠ ਕੇ ਹੀ ਔਨਲਾਈਨ ਵੀ ਖੇਡ ਸਕਦੇ ਹਾਂ ਇੱਕ ਦੂਜੇ ਨਾਲ ਸਮਾਰਟਫੋਨ ਦੇ ਕਾਰਨ ਹੀ ਇਹ ਸਭ ਕੁਛ ਪੋਸੀਬਲ ਹੋ ਪਾਇਆ ਹੈ